ਸਰ ਮੈਂ ਇੱਕ ਗੇਮਿੰਗ ਨਿਯੰਤਰਿਤ ਮਾਡਲ ਦੀ ਭਾਲ ਕਰ ਰਿਹਾ ਹਾਂ ਜੋ ਕਿ ਗੇਮਿੰਗ ਕੰਸੋਲ ਵੀ ਕਿਹਾ ਜਾਂਦਾ ਹੈ ਮੈਂ ਉਸਦੀ ਭਾਲ ਕਰ ਰਿਹਾ ਜਿਸ ਦੀ ਮੈਨੂੰ ਜ਼ਰੂਰਤ ਹੈ ਜੋ ਕਿ ਮੈਂ ਗੇਮਿੰਗ ਦੇ ਨਾਲ ਜੁੜਿਆ ਹੋਇਆ ਹਾਂ ਇਸ ਲਈ ਮੈਨੂੰ ਇਹ ਗੇਮਿੰਗ ਕੰਸੋਲ ਦੀ ਲੋੜ ਪਈ ਹੈ ਤਾਂ ਮੈਂ ਇਹ ਖਰੀਦਣਾ ਚਾਹੁੰਦਾ ਹਾਂ ਅਤੇ ਇਸ ਤਰੀਕੇ ਨਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਰੋਜਰ ਪ੍ਰੋ ਵਾਇਰਲੈਸ ਗੇਮਪੈਡ ਵਿਦ ਟੂ ਪੁਆਇੰਟ ਫੋਰ ਗੈਗਾਹਰਟਲ ਦਾ ਤੁਹਾਡੇ ਕੋਲ ਗੇਮਿੰਗ ਕੰਸੋਲ ਹੈ ਜਾਂ ਨਹੀਂ ਜੇਕਰ ਹੈ ਤਾਂ ਮੈਨੂੰ ਜੀਮੇਲ ਦੇ ਰਾਹੀਂ ਜਵਾਬ ਦੇ ਕੇ ਇਹ ਮੈਨੂੰ ਦੱਸ ਦਿਓ ਕਿਉਂਕਿ ਮੈਂ ਇਹ ਕੰਸੋਲ ਖਰੀਦਣਾ ਚਾਹੁੰਦਾ ਹਾਂ ਅਤੇ ਆਪਣੀ ਗੇਮਿੰਗ ਨੂੰ ਹੋਰ ਵਧੀਆ ਲੈਵਲ 'ਤੇ ਪਹੁੰਚਾਉਣਾ ਚਾਹੁੰਦਾ ਹਾਂ